ਜੀ ਹਾਂ ਸਕੂਲ ਦੇ ਫੰਕਸ਼ਨਾਂ ਦੇ ਵਿੱਚ ਹਿੱਸਾ ਲੈ ਲੈ ਕੇ ਹੀ ਮੈਂ ਵੱਡੀ ਹੋਈ ਹਾਂ ਅਤੇ ਅੱਜ ਬਤੌਰ ਅਧਿਆਪਕ ਮੈਂ ਸਕੂਲ ਦਾ ਪੂਰੇ ਦਾ ਪੂਰਾ ਫੰਕਸ਼ਨ ਤਿਆਰ ਕਰਦੀ ਹਾਂ ਮੇਰਾ ਇੱਕ ਲੰਬਾ ਤਜ਼ਰਬਾ ਹੈ ਮੈਂ ਬਹੁਤ ਛੋਟੀ ਸੀ ਜਦੋਂ ਤੋਂ ਭਾਸ਼ਣ ਮੁਕਾਬਲੇ ਕਵਿਤਾ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਲੱਗੀ ਫਿਰ ਮੇਰਾ ਕੋਲਜ ਦਾ ਦੌਰ ਆਇਆ ਜਦੋਂ ਮੈਂ ਨਾਟਕ ਕੀਤਾ ਨਾਟਕ ਦੇ ਨਾਲ ਮੋਮੈਟਿੰਗ ਦਾ ਮੇਰਾ ਖਾਸ ਤਜ਼ਰਬਾ ਰਿਹਾ ਇਸ ਤੋਂ ਇਲਾਵਾ ਗਿੱਧੇ ਭੰਗੜੇ ਦੇ ਵਿੱਚ ਮੇਰੀ ਜਿਹੜੀ ਸ਼ਮੂਲੀਅਤ ਰਹੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਅਧਿਆਪਕ ਬਣੀ ਅਧਿਆਪਕ ਬਣਨ ਸਾਰ ਹੀ ਸਭ ਤੋਂ ਪਹਿਲਾਂ ਮੈਨੂੰ ਕਿਸੇ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਸਿਰਫ ਤੇ ਸਿਰਫ ਫੰਕਸ਼ਨ ਤਿਆਰ ਕਰਨ ਲਈ ਹੀ ਰੱਖਿਆ ਤਾਂ ਮੈਂ ਵਿਦਿਆਰਥੀਆਂ ਦੇ ਅੰਦਰ ਇਸ ਕਲਾ ਨੂੰ ਪੈਦਾ ਕੀਤਾ ਭੰਗੜਾ ਸਿਖਾਇਆ ਗਿੱਧਾ ਸਿਖਾਇਆ ਔਰ ਫਿਰ ਮੈਂ ਗੌਰਮੈਂਟ ਜੋਬ ਦੇ ਵਿੱਚ ਆ ਗਈ ਤਾਂ ਉਸ ਤੋਂ ਬਾਅਦ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਖੇਡਾਂ ਦੇ ਵਿੱਚ ਗਿੱਧੇ ਦਾ ਮੁਕਾਬਲਾ ਹੁੰਦਾ ਸੀ ਜੋ ਅੱਜ ਕੱਲ੍ਹ ਬੰਦ ਹੋ ਗਿਆ ਉਹਦੇ ਵਿੱਚ ਮੈਂ ਪੰਜਾਬ ਜੇਤੂ ਰਹੀ ਮੇਰੀ ਟੀਮ ਮੇਰੇ ਬੱਚਿਆਂ ਦੀ ਪ੍ਰਾਇਮਰੀ ਪੱਧਰ 'ਤੇ ਅਤੇ ਵਿੱਦਿਅਕ ਮੁਕਾਬਲੇ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਹਨ ਪਹਿਲਾਂ ਮੈਂ ਉਹਨਾਂ ਮੁਕਾਬਲਿਆਂ ਵਿੱਚ ਬਤੌਰ ਵਿਦਿਆਰਥੀ ਹਿੱਸਾ ਲੈਂਦੀ ਸੀ ਅਤੇ ਪੰਜਾਬ ਪੱਧਰ ਤੱਕ ਪਹੁੰਚਦੀ ਸੀ ਅਤੇ ਪੁਜ਼ੀਸ਼ਨਾਂ ਵੀ ਹਾਸਲ ਕਰਦੀ ਸੀ ਹੁਣ ਮੇਰੇ ਵਿਦਿਆਰਥੀ ਉਨ੍ਹਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਨੇ ਅਤੇ ਪੰਜਾਬ ਪੱਧਰੀ ਮੁਕਾਬਲਿਆਂ ਦੇ ਤੱਕ ਪਹੁੰਚਦੇ ਨੇ ਅਤੇ ਬਹੁਤ ਵਾਰ ਜੇਤੂ ਵੀ ਰਹੇ ਨੇ ਖਾਸ ਤੌਰ 'ਤੇ ਭਾਸ਼ਣ ਅਤੇ ਲੋਕ ਨਾਚ ਦੇ ਵਿੱਚੋਂ ਮੇਰੇ ਵਿਦਿਆਰਥੀਆਂ ਨੇ ਬਹੁਤ ਵਾਰ ਜਿਹੜੀਆਂ ਹਨ ਉਹ ਮੋਹਰੀ ਸਥਾਨ ਜਿਹੜੇ ਪਹਿਲੇ ਸਥਾਨ ਨੇ ਉਹ ਮੱਲੇ ਨੇ ਅਤੇ ਹੁਣ ਵੀ ਮੈਂ ਨਿਰੰਤਰ ਜਿਹੜਾ ਹੈ ਪੰਜਾਬੀ ਸੱਭਿਆਚਾਰ ਅਤੇ ਸਕੂਲ ਦੇ ਫੰਕਸ਼ਨ 'ਤੇ ਕੰਮ ਕਰਦੀ ਹਾਂ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਿਵੇਂ ਫੰਕਸ਼ਨ 'ਤੇ ਸਕੂਲ 'ਤੇ ਸਕੂਲ ਦੇ ਵਿੱਚ ਸੱਭਿਆਚਾਰ ਗਤੀਵਿਧੀਆਂ ਮੇਰੇ ਅੰਦਰ ਰਚ ਮਿਚ ਜੇ ਗਈਆਂ ਹੋਣ ਤਾਂ ਅਕਸਰ ਹੀ ਮੈਂ ਅਤੇ ਮੇਰੇ ਵਿਦਿਆਰਥੀ ਬਹੁਤ ਸਾਰੀਆਂ ਸਹਿ ਵਿੱਦਿਅਕ ਗਤੀਵਿਧੀਆਂ ਕਰਦੇ ਰਹਿੰਦੇ ਹਾਂ ਅਤੇ ਬਹੁਤ ਸਾਰੀਆਂ ਗਤੀਵਿਧੀਆਂ ਦੀ ਜਜਮੈਂਟ ਕਰਨ ਦਾ ਵੀ ਮੈਨੂੰ ਮੌਕਾ ਮਿਲਦਾ ਰਹਿੰਦਾ